ਅੱਜ ਦੀ ਨੌਜਵਾਨ ਪੀੜ੍ਹੀ ਮੇਰੇ ਅਨੁਸਾਰ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸਖਤੀ ਨਾਲ ਪਾਲਣਾ ਕਰ ਰਹੀ ਹੈ ਇਵਨ ਕਿ ਅਗਰ ਮਾਂ ਬਾਪ ਕਰਦੇ ਵੀ ਆ ਸਖਤੀ ਤਾਂ ਕੋਈ ਵੀ ਬੱਚਾ ਨਹੀਂ ਸੁਣ ਰਿਹਾ ਉਸ ਚੀਜ਼ ਨੂੰ ਮਤਲਬ ਕੋਈ ਮੰਨਣਾ ਤਾਂ ਦੂਰ ਸਮਝਣਾ ਵੀ ਨਹੀਂ ਚਾਹੁੰਦਾ ਆਪਣੀ ਸੱਭਿਆਚਾਰਕ ਆਪਣੇ ਵਿਰਸੇ ਨੂੰ ਪੰਜਾਬੀਅਤ ਨੂੰ ਅਤੇ ਆਪਣੇ ਰੀਤੀ ਰਿਵਾਜ਼ਾਂ ਨੂੰ ਕੋਈ ਨਹੀਂ ਸਮਝਣਾ ਚਾਹੁੰਦਾ ਮਤਲਬ ਬਸ ਅੱਜ ਦੇ ਟਾਈਮ 'ਚ ਤਾ ਇਹ ਹੈ ਕਿ ਬਸ ਅਸੀਂ ਜੋ ਕਹਿ ਰਹੇ ਹਾਂ ਕਰ ਰਹੇ ਹਾਂ ਉਹ ਬਿਲਕੁਲ ਸਹੀ ਹੈ ਮਤਲਬ ਕੋਈ ਨਹੀਂ ਸਮਝਦਾ ਉਸ ਚੀਜ਼ ਨੂੰ ਔਰ ਪਕੜ ਢਿੱਲੀ ਪੈਣ ਬਾਰੇ ਤਾਂ ਰਾਏ ਕਿ ਜਦੋਂ ਨੌਜਵਾਨ ਪੀੜ੍ਹੀ ਸਮਝਣਾ ਹੀ ਨਹੀਂ ਚਾਹੁੰਦੀ ਤਾਂ ਅਸੀਂ ਉਹਨਾਂ ਨੂੰ ਸਖਤੀ ਨਾਲ ਕੁਛ ਵੀ ਨਹੀਂ ਕਰ ਸਕਦੇ ਬਸ